ਅੱਜ ਦੇ ਸਮੇਂ ਵਿੱਚ ਇਹ ਸਾਧਨਾਂ ਕਾਰਨ ਲੋਕਾਂ ਦੀ ਜ਼ਿੰਦਗੀ ਸੁਖਾਲ਼ੀ ਹੋ ਗਈ ਹੈ ਜੋ ਕਿ ਪਹਿਲਾਂ ਸਮੇਂ ਵਿੱਚ ਨਹੀਂ ਸੀ